ਅਸੀਂ ਇਤਿਹਾਸ ਵਿੱਚ ਆਪਣੇ ਖੇਤਰ ਅਤੇ ਆਲੇ ਦੁਆਲੇ ਦੇ ਹੋਰ ਖੇਤਰਾਂ ਵਿੱਚ ਅਸੀਂ ਹਿੰਦੂ ਪਾਕਿਸਤਾਨ ਦੇ ਬਟਵਾਰੇ ਬਾਰੇ ਹੀ ਸੁਣਿਆ ਹੈ ਇਸ ਬਟਵਾਰੇ ਵਿੱਚ ਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਸੂਬੇ 'ਤੇ ਹੀ ਪਿਆ ਇੱਥੇ ਬਰਸਾਂ ਤੋਂ ਰਹਿ ਰਹੇ ਸਿੱਖ ਮੁਸਲਮਾਨ ਹਿੰਦੂ ਆਪਸ ਵਿੱਚ ਮਿਲ ਜੁਲ ਕਰ ਪਹਿਲਾਂ ਰਹਿੰਦੇ ਸਨ ਜਦ ਇਹ ਪਹਿਲਾਂ ਇਹਨਾਂ ਦੀ ਵਿਰਾਸਤ ਵੀ ਸਾਂਝੀ ਸੀ ਪਰ ਜਦ ਇਹ ਦੇਸ਼ ਦਾ ਬਟਵਾਰਾ ਹੋਇਆ ਅਤੇ ਇਹ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਪੰਜਾਬ ਵਿੱਚ ਰਹਿਣ ਵਾਲੇ ਮੁਸਲਮਾਨ ਪੱਛਮੀ ਪੰਜਾਬ ਯਾਨੀ ਪਾਕਿਸਤਾਨ ਵੱਲ ਚੱਲਗੇ ਪੱਛਮੀ ਪੰਜਾਬ ਵਿੱਚ ਰਹਿਣ ਵਾਲੇ ਹਿੰਦੂ ਅਤੇ ਸਿੱਖ ਪੂਰਵੀ ਪੰਜਾਬ ਯਾਨੀ ਭਾਰਤ ਆਉਣ ਨੂੰ ਮਜਬੂਰ ਹੋ ਗਏ ਬਟਵਾਰੇ ਦੇ ਸਮੇਂ ਜੋ ਹਿੰਸਾ ਹੋਈ ਉਹ ਗ੍ਰਹਿ ਯੁੱਧ ਵੀ ਨਹੀਂ ਕਹਿ ਸਕਦੇ ਕਿਉਂਕਿ ਦੋਨਾਂ ਤਰਫ ਸੈਨਾਵਾਂ ਨੇ ਮੋਰਚਾ ਨਹੀਂ ਸੰਭਾਲਿਆ ਸੀ ਲੇਕਿਨ ਪਰ ਲੋਕ ਆਪਸ ਵਿੱਚ ਹੀ ਭੜਕ ਰਹੇ ਸਨ ਇੱਕ ਦੂਜੇ ਨੂੰ ਮਾਰ ਰਹੇ ਸਨ ਇਸਦਾ ਨਤੀਜੇ ਬਹੁਤ ਹੀ ਘਾਤਕ ਸਮ ਸਨ ਕਈ ਲੋਕਾਂ ਨੂੰ ਇਹਨਾਂ ਨੁਕਸਾਨਾਂ ਦਾ ਸਾਹਮਣਾ ਕਰਨਾ ਪਿਆ ਇਹ ਵਿਵਾਦ ਬਹੁਤ ਹੀ ਦਰਦਨਾਕ ਸਨ